ਹੈਲੋ ਹਾਂਜੀ ਤੁਸੀਂ ਫਲਿਪਕਾਰਟ ਤੋਂ ਬੋਲ ਰਹੇ ਹੋ ਹਾਂਜੀ ਹਾਂਜੀ ਮੈਂ ਰਣਜੀਤ ਸਿੰਘ ਗੱਲ ਕਰ ਰਿਹਾ ਹਾਂਜੀ ਸਰ ਮੈਂ ਨਾ ਇੱਕ ਟੀਸ਼ਰਟ ਔਡਰ ਕੀਤੀ ਸੀ ਤੁਹਾਡੇ ਕੋਲੋਂ ਹਾਂਜੀ ਉਹ ਬਿਲਕੁਲ ਹੀ ਘਟੀਆ ਹੈ ਉਹਦਾ ਨਾਂ ਤਾਂ ਸਟਫ ਚੰਗਾ ਹੈ ਨਾ ਹੀ ਕਲਰ ਚੰਗਾ ਹੈ ਉਸਦਾ ਸਭ ਕੁਝ ਘਟੀਆ ਹਾਂ ਉਹਦਾ ਕਲਰ ਦੇਖੋ ਤੁਸੀਂ ਕਿੰਨਾ ਗੰਦਾ ਦਿੱਤਾ ਉਸਦਾ ਪਰ ਮੈਂ ਕੀ ਆਰਡਰ ਕੀਤਾ ਸੀ ਤਾਂ ਤੁਸੀਂ ਕੀ ਭੇਜਿਆ ਮੇਰੇ ਕੋਲ ਹਾਂ ਹਾਂ ਅਤੇ ਸਟਫ ਦੇਖੋ ਉਸਦਾ ਬਿਲਕੁਲ ਐਵੇਂ ਦੇਖੋ ਤੁਸੀਂ ਇਹ ਪਾਉਣ ਵਾਲੀ ਚੀਜ਼ ਆ ਕੋਈ ਦੱਸੋ ਤੁਸੀਂ ਪਾ ਸਕਦੇ ਇਹੋ ਜਿਹੀ ਚੀਜ਼ ਇੰਨੀ ਘਟੀਆ ਇੰਨੀ ਘਟੀਆ ਡਿਜ਼ਾਇਨਿੰਗ ਇਸਦੀ ਇ ਇਹੋ ਜਿਹੀ ਚੀਜ਼ ਵੇਚਦੇ ਹੋ ਤੁਸੀਂ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਮੈਂ ਨਹੀਂ ਲੈਣੀ ਮੈਂ ਸੀ ਮੇ ਮੈਂ ਰੀਫੰਡ ਕਰਨੀ ਆ ਮੈਨੂੰ ਨਹੀਂ ਚਾਹੀਦੀ ਇਹ ਟੀਸਰਟ ਤੁਸੀਂ ਮੇਰਾ ਬਸ ਆਰਡਰ ਮਤਲਬ ਕੈਂਸਲ ਕਰੋ ਬਸ ਮੈਨੂੰ ਨਹੀਂ ਚਾਹੀਦਾ ਅਤੇ ਰੀਫੰਡ ਕਰੋ ਇਸਨੂੰ ਹਾਂਜੀ ਥੈਂਕ ਯੂ